ਜੇਕਰ ਗੱਲ ਕਰਦੇ ਹਾਂ ਆਪਾਂ ਪੱਗ ਦੀ ਤਾਂ ਪੱਗ ਪੰਜਾਬੀਆਂ ਦੀ ਆਨ ਬਾਨ ਅਤੇ ਸ਼ਾਨ ਮੰਨੀ ਜਾਂਦੀ ਹੈ ਜਿਵੇਂ ਕਿ ਇੱਕ ਰਾਜੇ ਦੇ ਸਿਰ 'ਤੇ ਇੱਕ ਤਾਜ ਰੱਖਿਆ ਜਾਂਦਾ ਹੈ ਉਵੇਂ ਹੀ ਇੱਕ ਬੰਦੇ ਦੇ ਸਿਰ 'ਤੇ ਪੱਗ ਦਾ ਪੱਗ ਰੂਪੀ ਤਾਜ ਰੱਖਿਆ ਜਾਂਦਾ ਹੈ ਪੱਗ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਕਿ ਪਟਿਆਲਾ ਸ਼ਾਹੀ ਪੱਗ ਹੋ ਗਈ ਅੰਮ੍ਰਿਤਸਰੀਆ ਪੱਗ ਹੋ ਗਈ ਪੇਚਾਂ ਵਾਲੀ ਪੱਗ ਹੋ ਗਈ ਬਟਾਂ ਵਾਲੀ ਪੱਗ ਹੋ ਗਈ ਅੱਜ ਵੀ ਪੱਗ ਦੇ ਕਈ ਕਈ ਰੂਪ ਹੈ ਜੋ ਲੋਕ ਬੰਨ੍ਹਦੇ ਹੈ ਜੋ ਲੋਕਾਂ ਨੂੰ ਵਧੀਆ ਲੱਗਦੀ ਹੈ ਜਿਹਨਾਂ ਵਿੱਚੋਂ ਮੈਨੂੰ ਵੀ ਵਧੀਆ ਲੱਗਦੀ ਹੈ ਮੈਨੂੰ ਵਧੀਆ ਲੱਗਦੀ ਹੈ ਬਟਾਂ ਵਾਲੀ ਪੱਗ ਮੈਂ ਜਦੋਂ ਵੀ ਬੰਨਦਾ ਹਾਂ ਆਪਣੇ ਤਾਂ ਬਟਾਂ ਵਾਲੀ ਪੱਗ ਹੀ ਬੰਨ੍ਹਦਾ ਹਾਂ ਪੱਗ ਬੰਨਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪੱਗ ਬੰਨ੍ਹਣੀ ਆਉਣੀ ਚਾਹੀਦੀ ਹੈ ਪਹਿਲਾਂ ਆਪਾਂ ਸਿੱਖੇ ਹੋਣੇ ਚਾਹੀਦੇ ਹਾਂ ਉਸ ਤੋਂ ਬਾਅਦ ਆਪਾਂ ਪੱਗ ਬੰਨ੍ਹ ਸਕਦੇ ਹਾਂ ਅਤੇ ਵਧੀਆ ਢੰਗ ਨਾਲ ਪੱਗ ਬੰਨ੍ਹ ਸਕਦੇ ਹਾਂ ਜੋ ਸਾਡੇ ਸਿਰ 'ਤੇ ਸੋਹਣੀ ਵੀ ਲੱਗੇ ਔਰ ਜਿਵੇਂ ਇੱਕ ਤਾਜ ਵਧੀਆ ਲੱਗਦਾ ਨਾ ਇੱਕ ਇਨਸਾਨ ਦੇ ਸਿਰ 'ਤੇ ਉਵੇਂ ਹੀ ਪੱਗ ਵੀ ਇੱਕ ਤਾਜ ਹੀ ਹੁੰਦਾ ਅਤੇ ਉਹ ਵੀ ਉਵੇਂ ਹੀ ਸੋਹਣੀ ਲੱਗਣੀ ਚਾਹੀਦੀ ਹੈ ਪੱਗ ਬੰਨ੍ਹਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਸੱਤ ਮੀਟਰ ਦਾ ਸੱਤ ਜਾਂ ਸਵਾ ਸੱਤ ਮੀਟਰ ਦਾ ਕੱਪੜਾ ਲੈਣਾ ਪੈਂਦਾ ਹੈ ਅਤੇ ਉਹ ਜਾਂ ਤਾਂ ਇੱਕ ਪੱਲੀ ਪੱਗ ਹੁੰਦੀ ਹੈ ਜਾਂ ਦੋ ਪੱਲੀ ਪੱਗ ਹੁੰਦੀ ਹੈ ਉਹਦੇ ਲਈ ਉਹ ਬੰਦੇ 'ਤੇ ਡਿਪੈਂਡ ਕਰਦਾ ਕਿ ਉਹਨੇ ਕਿਵੇਂ ਦੀ ਪੱਗ ਬੰਨ੍ਹਣੀ ਹੈ ਉਸ ਤੋਂ ਬਾਅਦ ਇੱਕ ਪੱਗ ਦੀ ਪੂਣੀ ਕੀਤੀ ਜਾ ਪੱਗ ਦੀ ਪੂਣੀ ਕੀਤੀ ਜਾਂਦੀ ਹੈ ਅਤੇ ਫਿਰ ਸ਼ੀਸ਼ੇ ਸਾਹਮਣੇ ਖੜ੍ਹ ਕੇ ਉਹ ਪੱਗ ਬੰ ਬੰਨੀ ਜਾਂਦੀ ਹੈ ਪੱਗ ਜਾਂ ਤਾਂ ਲੋਕ ਅ ਦੇਖਿਆ ਜਾਵੇ ਆਲਮੋਸਟ ਤਾਂ ਲੋਕ ਬਟਾਂ ਵਾਲੀ ਪੱਗ ਹੀ ਬੰਨ੍ਹਦੇ ਹੈ ਪਟਿਆਲਾ ਸ਼ਾਹੀ ਪੱਗ ਬੰਨ੍ਹਣ ਦੇ ਲਈ ਦੇਖਿਆ ਜਾਵੇ ਤਾਂ ਕੁਛ ਅ ਖ਼ਾਸ ਤਕਨੀਕਾਂ ਹੁੰਦੀਆਂ ਉਹਦੇ ਲਈ ਵੀ ਅਤੇ ਜੇਕਰ ਬਟਾਂ ਵਾਲੀ ਪੱਗ ਦੇਖੀ ਜਾਵੇ ਉਹਦੇ ਲਈ ਕੁਝ ਖ਼ਾਸ ਤਕਨੀਕਾਂ ਦੀ ਜ਼ਰੂਰਤ ਨਹੀਂ ਪੈਂਦੀ ਹਰ ਕੋਈ ਵਧੀਆ ਤਰੀਕੇ ਨਾਲ ਬੰਨ੍ਹ ਸਕਦਾ ਜ ਉਹ ਐਹ ਜ ਐਵੇਂ ਦੀ ਪੱਗ ਹੈ ਜੋ ਹਰ ਇੱਕ ਇਨਸਾਨ ਹੀ ਬਣ ਸਕਦਾ ਹੈ ਪੱਗ ਪੱਗ ਬੰਨ ਬੰਨਿਆ ਹਰ ਇੱਕ ਇਨਸਾਨ ਸੋਹਣਾ ਹੀ ਲੱਗਦਾ ਹੈ ਜੇਕਰ ਉਸ ਨੂੰ ਦੇਖਦੇ ਹਾਂ ਤਾਂ ਐਵੇਂ ਲੱਗਦਾ ਹੈ ਕੋਈ ਰਾਜਾ ਹੋਵੇ ਮੇਰੇ ਘਰ ਦੇ ਵੀ ਮੈਨੂੰ ਐਵੇਂ ਕਹਿੰਦੇ ਆ ਕਿ ਪੱਗ ਬੰਨਿਆ ਤੂੰ ਬਹੁਤ ਸੋਹਣਾ ਲੱਗਦਾ ਹੈ ਕਿ ਪੱਗ ਬੰਨਿਆ ਕਰ ਹੁਣ ਮੈਂ ਆਲਮੋਸਟ ਪੱਗ ਬੰਐ ਹੀ ਲੈਨਾ ਕਿਉਂਕਿ ਮੈਨੂੰ ਵੀ ਸੋਹਣੀ ਲੱਗਦੀ ਹੈ ਮੈਂ ਖਾਸ ਕਰਕੇ ਤਾਂ ਖ਼ਾਸ ਮੌਕਿਆਂ 'ਤੇ ਪੱਗ ਬੰਨ੍ਹਦਾ ਜਿਵੇਂ ਕਿ ਵਿਆਹ ਸ਼ਾਦੀਆਂ 'ਤੇ ਜਾਂ ਕਿਸੇ ਪਾਰਟੀ 'ਤੇ ਜਾਂ ਕਾਲਜ ਯੂਨੀਵਰਸਿਟੀ ਵੀ ਜਾਣਾ ਹੋਵੇ ਤਾਂ ਵੀ ਮੈਂ ਪੱਗ ਬੰਨ੍ਹ ਹੀ ਲੈਨਾ ਕਿਉਂਕਿ ਮੈਨੂੰ ਸੋਹਣੀ ਲੱਗਦੀ ਆ ਅਤੇ ਦੇਖਣ ਵਾਲਾ ਵੀ ਇਹ ਕਹਿੰਦਾ ਕਿ ਹਾਂ ਬਈ ਸੋਹਣਾ ਲੱਗ ਰਿਹਾ ਬੰਦਾ ਪੱਗ ਬੰਨੀ